ਸਾਡੇ ਖੇਤਰ ਵਿੱਚ ਕਈ ਕਿਲ੍ਹੇ ਬਣਾਏ ਹੋਏ ਹਨ ਜਿਹਨਾਂ ਵਿੱਚ ਇੱਕ ਮਨਾਲੀ ਕਿਲ੍ਹਾ ਹੈ ਜੋ ਕਿ ਏਅਰਪੋਰਟ ਰੋਡ 'ਤੇ ਸਥਿਤ ਹੈ ਇਹ ਕਿਲ੍ਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੌਰਾਨ ਬਣਾਇਆ ਗਿਆ ਸੀ ਉਸ ਸਮੇਂ ਮੁਗਲਾਂ ਅਤੇ ਖਾਲਸਾ ਵਿਚਕਾਰ ਲੜਾਈ ਚੱਲ ਰਹੀ ਸੀ ਇਸਨੂੰ ਕਿਲ੍ਹਾ ਮਨਾਲੀ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਕਿਲ੍ਹਾ ਬਾਰਾਂ ਮਈ ਸਤਾਰਾਂ ਸੌ ਦਸ ਈਸਵੀ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖਾਂ ਵਿੱਚ ਲੜਕ ਲੜਾਈ ਚੱਲ ਰਹੀ ਸੀ ਤਾਂ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਸਦੀ ਯਾਦ ਵਿੱਚ ਇਹ ਕਿਲ੍ਹਾ ਬਣਾਇਆ ਗਿਆ ਸੀ ਇਸ ਨੂੰ ਫਤਿਹ ਬੁਰਜ਼ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ ਇਹ ਮੈਦਾਨ ਬਹੁਤ ਹੀ ਜ਼ਿਆਦਾ ਸੁੰਦਰ ਹੈ ਇਸ ਵਿੱਚ ਬਹੁਤ ਹੀ ਸੋਹਣੀਆਂ ਮੂਰਤੀਆਂ ਬਣਾ ਬੰਦਾ ਸਿੰਘ ਬਹਾਦਰ ਦੀਆਂ ਸੋਹਣੀ ਮੂਰਤੀਆਂ ਬਣਾਈਆਂ ਗਈਆ ਹਨ ਇਸ ਵਿੱਚ ਕਈ ਤ ਤਲਾਬ ਅਤੇ ਫੁੱਲ ਲ ਲਗਾਏ ਹੋਏ ਹਨ ਇੱਥੇ ਬਹੁਤ ਹੀ ਜ਼ਿਆਦਾ ਸੋਹਣੀ ਚਿੜੀਆਂ ਵੀ ਰਹਿੰਦੀਆਂ ਹਨ ਇਹ ਇਤਿਹਾਸਕ ਹੋਣ ਦੇ ਨਾਨ ਨਾਲ਼ ਨਾਲ਼ ਸੋਹਣਾ ਵੀ ਹੈ